ਮੈਨੂੰ ਬਚਪਨ ਵਿੱਚ ਹੀ ਬੁਣਾਈ ਅਤੇ ਸਿਲਾਈ ਕਰਨ ਦਾ ਸ਼ੌਂਕ ਹੈ ਮੈਂ ਆਪਣੀ ਦਾਦੀ ਜੀ ਤੋਂ ਇਸ ਕੰਮ ਦੀ ਦਿਲਚਸਪੀ ਲਈ ਸੀ ਉਹਨਾਂ ਨੂੰ ਕਰਦੇ ਹੋਏ ਦੇਖਿਆ ਸੀ ਜਿਹਦੇ ਕਰਕੇ ਮੈਨੂੰ ਵੀ ਬੁਣਾਈ ਅਤੇ ਸਿਲਾਈ ਦਾ ਸ਼ੌਂਕ ਪੈਦਾ ਹੋਇਆ ਹੁਣ ਮੈਂ ਬਹੁਤ ਹੀ ਜ਼ਿਆਦਾ ਟ੍ਰੇਨਡ ਹੋ ਚੁੱਕੀ ਹਾਂ ਮੈਂ ਹਰ ਤਰ੍ਹਾਂ ਦੇ ਹਰ ਕਿਸਮ ਦੇ ਕੱਪੜੇ ਸਿਉਂ ਲੈਦੀ ਹਾਂ ਜਿੱਦਾਂ ਦਾ ਮੈਨੂੰ ਕੋਈ ਗਾਹਕ ਆ ਕੇ ਮੈਨੂੰ ਡਿਜ਼ਾਇਨ ਦਿਖਾਉਂਦਾ ਹੈ ਅਤੇ ਮੈਂ ਉੱਦਾਂ ਦੀ ਹੀ ਉਹਨੂੰ ਸਿਲਾਈ ਕਰਕੇ ਦੇ ਦਿੰਦੀ ਹਾਂ ਸੂਟ ਟੋਪੀਆਂ ਕੱਪੜੇ ਹਰ ਤਰ੍ਹਾਂ ਦੇ ਦਸਤਾਨੇ ਵਗੈਰਾ ਸਵੈਟਰ ਹਰ ਤਰ੍ਹਾਂ ਦੇ ਕੱਪੜੇ ਮੈਂ ਆਪ ਸਿਉਂ ਲੈਂਦੀ ਮੈਂ ਲੱਡੂ ਗੋਪਾਲ ਜੀ ਦੇ ਕੱਪੜੇ ਵੀ ਬਹੁਤ ਵਧੀਆ ਸਿਉਂ ਲੈਂਦੀ ਹਾਂ ਮੈਨੂੰ ਹੋਰ ਵੀ ਬਹੁਤ ਕੰਮ ਸਾਰੇ ਕੱਪੜਿਆਂ ਵਿੱਚ ਸਿਉਣ ਦੀ ਦਿਲਚਸਪੀ ਹੈ ਮੈਂ ਹਰ ਕੱਪੜਾ ਡਿਜ਼ਾਇਨ ਦੇ ਹਿਸਾਬ ਨਾਲ ਗਾਹਕ ਦੇ ਹਿਸਾਬ ਨਾਲ ਸਿਉਂ ਲੈਂਦੀ ਹਾਂ ਇਹਦੇ ਮੈਨੂੰ ਸਭ ਤੋਂ ਜ਼ਿਆਦਾ ਲੱਡੂ ਗੋਪਾਲ ਜੀ ਦੇ ਕੱਪੜੇ ਬਣਾਉਣ ਦਾ ਬਹੁਤ ਸ਼ੌਂਕ ਹੈ ਮੈਂ ਲੱਡੂ ਗੋਪਾਲ ਜੀ ਨੂੰ ਬਹੁਤ ਮੰਨਦੀ ਹਾਂ ਅਤੇ ਉਹਨਾਂ ਦੇ ਕੱਪੜਿਆਂ ਨੂੰ ਬਣਾਉਣਾ ਬਣਾਉਣ ਦਾ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਉਹਨਾਂ ਦੇ ਕੱਪੜੇ ਮੈਨੂੰ ਬਣਾਉਣੇ ਬਹੁਤ ਹੀ ਪਸੰਦ ਮੈਂ ਉਹਨਾਂ ਦੀ ਤਰ੍ਹਾਂ ਤਰ੍ਹਾਂ ਦੀ ਸਵੈਟਰਾਂ ਤਰ੍ਹਾਂ ਤਰ੍ਹਾਂ ਦੇ ਦਸਤਾਨੇ ਕੱਪੜੇ ਉਹਨਾਂ ਦੇ ਕੱਪੜੇ ਬਣਾਉਂਦੀ ਰਹਿੰਦੀ ਹਾਂ ਜਿਹਦੇ ਕਰਕੇ ਮੈਨੂੰ ਕਈ ਗ੍ਰਾਹਕਾਂ ਨੇ ਵੀ ਉਹਨਾਂ ਦਾ ਅ ਕੱਪੜਿਆਂ ਬਣਾਉਣ ਦਾ ਆਰਡਰ ਦਿੱਤਾ ਹੈ ਕਿ ਉਹਨਾਂ ਦੇ ਘਰ ਵੀ ਲੱਡੂ ਗੋਪਾਲ ਜੀ ਹੈ ਕ੍ਰਿਸ਼ਨ ਜੀ ਰੱਖੇ ਹੋਏ ਹਨ ਉਹਨਾਂ ਸਾਰਿਆਂ ਨੇ ਵੀ ਮੈਨੂੰ ਇਹ ਬਣਾਉਣ ਦਾ ਆਰਡਰ ਦਿੱਤਾ ਹੈ ਅਤੇ ਹੋਰ ਵੀ ਮੈਂ ਬਹੁਤ ਸਾਰੀਆਂ ਚੀਜ਼ਾਂ ਬਣਾ ਲੈਂਦੀ ਕੋਈ ਡਿਜ਼ਾਈਨਰ ਡਰੈਸ ਕੋਈ ਵੀ ਕੱਪੜੇ ਦਾ ਮੈਨੂੰ ਡਿਜ਼ਾਇਨ ਦੇ ਦਿਓ ਮੈਂ ਹਰ ਤਰ੍ਹਾਂ ਦਾ ਕੱਪੜਾ ਸਿਉਂ ਲੈਂਦੀ ਹਾਂ ਅਤੇ ਮੈਨੂੰ ਇਹ ਕੰਮ 'ਚ ਬਹੁਤ ਹੀ ਜ਼ਿਆਦਾ ਮਜ਼ਾ ਸਕੂਨ ਮਿਲਦਾ ਹੈ ਮੈਂ ਹਰ ਡਿਜ਼ਾਇਨ ਦੇ ਕੱਪੜੇ ਸਿਉਂ ਲੈਂਦੀ ਹਾਂ ਮੈਨੂੰ ਬੁਣਾਈ ਸਿਲਾਈ ਕਰਨ ਦਾ ਬਚਪਨ ਤੋਂ ਹੀ ਸ਼ੌਂਕ ਸੀ ਅਤੇ ਇਹ ਕੰਮ ਨੇ ਮੇਰਾ ਹੋਰ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਹੈ